ਹਾਂ ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਮਨੋਰੰਜਨ ਗਤੀਵਿਧੀਆਂ ਅਤੇ ਮਨੋਰੰਜਨ ਦੇ ਬਹੁਤ ਸਾਰੇ ਵਿਕਲਪ ਹਨ ਜਿਵੇਂ ਕਿ ਰਣਜੀਤ ਪਾਰਕ ਸਤਲੁਜ ਦਰਿਆ ਬਹੁਤ ਸਾਰੇ ਸਿਨੇਮੇ ਮਿਊਜ਼ੀਅਮ ਥੀਏਟਰ ਬਹੁਤ ਕੁਛ ਹੈ ਕੁਛ ਜਗ੍ਹਾ 'ਤੇ ਜਾਣ ਲਈ ਜਿਵੇਂ ਕਿ ਸਿਨੇਮਾ ਘਰ ਹੋਇਆ ਮਿਊਜ਼ੀਅਮ ਹੋਏ ਉੱਥੇ ਸਾਨੂੰ ਪੈਸੇ ਦੇਣੇ ਪੈਂਦੇ ਹਨ ਪਰ ਜਿਵੇਂ ਪਾਰਕਾਂ ਵਿੱਚ ਜਾਂ ਸਤਲੁਜ ਦਰਿਆ 'ਤੇ ਅਸੀਂ ਘੁੰਮਣ ਲਈ ਜਾਣਾ ਹੈ ਉੱਥੇ ਸਾਨੂੰ ਕੋਈ ਵੀ ਪੈਸਾ ਨਹੀਂ ਦੇਣਾ ਪੈਂਦਾ ਉੱਥੇ ਅਸੀਂ ਫਰੀ ਵਿੱਚ ਜਾ ਸਕਦੇ ਹਾਂ